ਪਿੰਡ ਦੇ ਬਿਜਨਸ ਸਾਡਾ ਖੇਤੀਬਾੜੀ ਦਾ ਵਧੀਆ ਕੰਮ ਚੱਲਦਾ ਹੈ ਜਿਸ ਵਿੱਚ ਸਾਨੂੰ ਖੇਤ ਇੱਥੇ ਹੀ ਵਧੀਆ 'ਚ ਕੰਮ ਚਲਾਈ ਜਾਂਦੇ ਹਾਂ ਜਿਵੇਂ ਕਿ ਪਸ਼ੂ ਪਾਲਣ ਦਾ ਕੰਮ ਵੀ ਸਾਡਾ ਪਿੰਡ ਵਿੱਚ ਹੀ ਵਧੀਆ ਚੱਲਦਾ ਹੈ ਅਸੀਂ ਡੇਅਰੀ ਫਾਰਮ ਵੀ ਖੋਲ੍ਹਿਆ ਹੋਇਆ ਹੈ ਜਿਹਦੇ ਵਿੱਚ ਅਸੀਂ ਦੁੱਧ ਆਦਿ ਦਾ ਬਿਜਨਿਸ ਕਰਦੇ ਹਾਂ ਇਸ ਕ ਬਿਜਨਿਸ ਪਿੰਡ ਵਿੱਚ ਅਸੀਂ ਬਿਊਟੀ ਪਾਰਲਰ ਦਾ ਵੀ ਬਿਜਨਿਸ ਖੋਲ੍ਹਿਆ ਹੋਇਆ ਹੈ ਬਿਊਟੀ ਪਾਰਲਰ ਦਾ ਕੰਮ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਕੱਪੜੇ ਸੀਣ ਦਾ ਬਿਜਨਸ ਵੀ ਕਰਦੇ ਹਾਂ ਕੱਪੜੇ ਸਾਨੂੰ ਸ਼ਹਿਰ ਵਿੱਚ ਨਹੀਂ ਸਵਾਉਣ ਜਾਣਾ ਪੈਂਦਾ ਪਿੰਡ ਵਿੱਚ ਵੀ ਹੋ ਜਾਂਦੇ ਹਨ ਸੂਟਾਂ ਉੱਪਰ ਕਢਾਈ ਕਰਵਾਉਣੀ ਉਹ ਵੀ ਸਾਡੇ ਪਿੰਡ ਵਿੱਚ ਹੀ ਕੀਤੀ ਜਾਂਦੀ ਹੈ ਸਾਨੂੰ ਵਧੀਆ ਲੱਗਦਾ ਹੈ ਸਾਡੇ ਪਿੰਡ ਵਿੱਚ ਇੰਨੇ ਵਧੀਆ ਬਿਜਨਸ ਚੱਲ ਰਹੇ ਨੇ ਸਾਨੂੰ ਸਾਰੀਆਂ ਸਹੂਲਤਾਂ ਸ਼ਹਿਰ ਵਰਗੀਆਂ ਪਿੰਡ ਵਿੱਚ ਹੀ ਮਿਲ ਜਾਂਦੀਆਂ ਹਨ ਇਸ ਕਰਕੇ ਸਾਡਾ ਮੇਨ ਕਿੱਤਾ ਹੈ ਖੇਤੀਬਾੜੀ ਅਤੇ ਪਸ਼ੂ ਪਾਲਣ